ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਆਪਣੀ ਸਹੇਲੀ ਤੋਂ ਤੁਹਾਡਾ ਨੰਬਰ ਲਿਆ ਸੀ ਹਾਂਜੀ ਅਤੇ ਮੈਂ ਆਪਣਾ ਪਟਨਾ ਸਾਹਿਬ ਤੋਂ ਬੋਲ ਰਹੀ ਹਾਂ ਅਤੇ ਮੈਂ ਪਟਨਾ ਸਾਹਿਬ ਤੋਂ ਇੱਥੇ ਪੰਜਾਬ ਵਿੱਚ ਨੌਕਰੀ ਲਈ ਆਉਣਾ ਹੈ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਬਈ ਮਤਲਬ ਕਿ ਇੱਥੇ ਕਿੱਥੇ ਵਧੀਆ ਨੌਕਰੀ ਦੇ ਉਹ ਹੈਗੇ ਆ ਮਿਲ ਸਕਦੀ ਆ ਬਈ ਰਹਿਣ ਰੁਹਣ ਦੇ ਲਈ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਵੀ ਮਤਲਬ ਕਿ ਜਿੱਥੇ ਮੈਨੂੰ ਜੌਬ ਨੌਕਰੀ ਹੈ ਨਾ ਆਪਣੀ ਮਿਲ ਜਾਵੇ ਵਧੀਆ ਰਹਿਣ ਰੂਹਣ ਦਾ ਕੋਈ ਉਹ ਨਾ ਹੋਵੇ ਅੱਛਾ ਜੀ ਠੀਕ ਹੈ ਜੀ ਹਾਂਜੀ ਚਲੋ ਫੇਰ ਮੈਂ ਜਦੋਂ ਵੀ ਆਉਣਾ ਹੋਇਆ ਫੇਰ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਫ਼ੋਨ ਕਰ ਲੂੰਗੀ ਹਾਂਜੀ ਫਿਰ ਤੁਸੀਂ ਜੇ ਮੈਨੂੰ ਤੁਹਾਡੀ ਮਦਦ ਚਾਹੀਦੀ ਹੋਈ ਫੇਰ ਤੁਸੀਂ ਮੈਂ ਤੁਹਾਨੂੰ ਫ਼ੋਨ ਕਰ ਲੂੰਗੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ